ਯੋਗਾ ਸੈਸ਼ਨਾਂ ਵਿਚ ਦਿਮਾਗੀ ਸੋਚ ਨੂੰ ਜ਼ਬਰਦਸਤੀ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਹਾਂ 'ਤੇ ਧਿਆਨ ਲਗਾ ਕੇ ਉਹਨਾਂ ਦੇ ਵੇਗ ਨੂੰ ਨਿਯੰਤਰਿਤ ਕਰਕੇ ਆਪਣੇ ਆਲੇ ਦੁਆਲੇ ਦੀ ਆਵਾਜ਼ਾਂ ਪ੍ਰਤੀ ਸਜਗ ਹੋ ਕੇ ਇੱਕ ਇੱਕ ਵਿਚਾਰ ਨੂੰ ਦਿਮਾਗ 'ਚੋਂ ਕੱਢਣਾ ਹੁੰਦਾ ਹੈ